ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ 'ਚ ਡਾਂਸ ਸਿੱਖਣ ਲਈ ਸਾਨੂੰ ਇੱਕ ਗੁਰੂ ਕੋਲ਼ ਜਾਣਾ ਪੈਂਦਾ ਸੀ ਜੋ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਫੀਸ ਲੈਂਦਾ ਸੀ ਅਤੇ ਉਹ ਫੀਸ ਕਈ ਬੱਚੇ ਨਹੀਂ ਦੇ ਸਕਦੇ ਸੀ ਜਿਸ ਕਰਕੇ ਉਨ੍ਹਾਂ ਨੂੰ ਆਪਣਾ ਡਾਂਸ ਸਿੱਖਣ ਦਾ ਸ਼ੌਕ ਮਾਰਨਾ ਪੈਂਦਾ ਸੀ ਅਤੇ ਪੁਰਾਣੇ ਸਮੇਂ ਵਿੱਚ ਕੁੜੀਆਂ ਨੂੰ ਵੀ ਡਾਂਸ ਸਿੱਖਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ ਉਨ੍ਹਾਂ ਨੂੰ ਤਾਂ ਘਰ ਤੋਂ ਬਾਹਰ ਹੀ ਨਹੀਂ ਕੱਢਿਆ ਜਾਂਦਾ ਸੀ ਤਾਂ ਉਨ੍ਹਾਂ ਨੇ ਡਾਂਸ ਕਿੱਥੋਂ ਸਿੱਖਣਾ ਸੀ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਸਾਰਾ ਕੁਛ ਔਨਲਾਈਨ ਆ ਗਿਆ ਹੈ ਆਪਾਂ ਔਨਲਾਈਨ ਡਾਂਸ ਸਿੱਖ ਸਕਦੇ ਹਾਂ ਔਨਲਾਈਨ ਡਾਂਸ ਸਿੱਖਣ ਦੇ ਬਹੁਤ ਸਾਰੇ ਫਾਇਦੇ ਹਨ ਜੋ ਗੁਰੂ ਬਹੁਤ ਜ਼ਿਆਦਾ ਮਾਤਰਾ ਵਿੱਚ ਫੀਸ ਲੈਂਦੇ ਸੀ ਪਹਿਲਾਂ ਹੁਣ ਆਪਾਂ ਔਨਲਾਈਨ ਸਿੱਖ ਸਕਦੇ ਹਾਂ ਜਿਸ ਦੀ ਕੋਈ ਵੀ ਫੀਸ ਨਹੀਂ ਲੱਗਦੀ ਅਤੇ ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਆਪਾਂ ਉਸ ਡਾਂਸ ਨੂੰ ਵਾਰ ਵਾਰ ਦੇਖ ਸਕਦੇ ਹਾਂ ਯੂਟਿਊਬ ਤੋਂ ਕਿ ਉਹ ਕਿੱਦਾਂ ਕਿਹੜਾ ਸਟੈੱਪ ਕਰਦਾ ਹੈ ਧੰਨਵਾਦ